ਈਬੁੱਕ ਇਲੈਕਟਰੋਨਿਕ ਬੁੱਕ ਜਾਂ ਇਲੈਕਟਰੋਨਿਕ ਕਿਤਾਬ ਇਹ ਪੜ੍ਹਾਈ ਦਾ ਇੱਕ ਬਹੁਤ ਵਧੀਆ ਸਾਧਨ ਹੈ ਜਿਹਦੇ ਨਾਲ ਅਸੀਂ ਪੜ੍ਹ ਸਕਦੇ ਹਾਂ ਅਸੀਂ ਕਿਸੇ ਵੀ ਸਥਾਨ 'ਤੇ ਜਾਂਦੇ ਹੋਏ ਬੈਠ ਕੇ ਖੜ੍ਹ ਕੇ ਆਪਣਾ ਫੋਨ ਖੋਲ੍ਹ ਕੇ ਉਸ ਦੇ ਵਿੱਚ ਹੈ ਜਿਹੜੀ ਈਬੁੱਕ ਹੋਵੇਗੀ ਉਹਦੇ ਨਾਲ ਪੜ੍ਹ ਸਕਦੇ ਹਾਂ ਇਹ ਇੱਕ ਸਸਤਾ ਸਾਧਨ ਹੈ ਕਿਉਂਕਿ ਜੇ ਆਪਾਂ ਆਮ ਕਿਤਾਬ ਲਈਏ ਤਾਂ ਹਰ ਇੱਕ ਕਿਤਾਬ ਆ ਜਿਹੜੀ ਉਹ ਲਗਭਗ ਸੌ ਰੁਪਏ ਦੀ ਇੱਕ ਕਿਤਾਬ ਆਪਾਂ ਮੰਨਦੇ ਹਾਂ ਕਿ ਸੌ ਦੀ ਕਿਤਾਬ ਇੱਕ ਆਉਂਦੀ ਹੈ ਪਰ ਈਬੁੱਕ ਹੈ ਉਸ ਦਾ ਇੱਕ ਵਾਰ ਆਪਾਂ ਡਾਊਨਲੋਡ ਕਰ ਲਈ ਉਹਨੂੰ ਆਪਾਂ ਅੱਗੇ ਦੀ ਅੱਗੇ ਸ਼ੇਅਰ ਕਰ ਗਏ ਫਰੀ ਦੇ ਵਿੱਚ ਸ਼ੇਅਰ ਕਰ ਸਕਦੇ ਹਾਂ ਕਿ ਇਸ ਦੇ ਨਾਲ ਹੀ ਨਾ ਤਾਂ ਇਹ ਖ਼ਰਾਬ ਹੋਵੇ ਨਾ ਇਹ ਚੋਰੀ ਹੋਵੇ ਕਿਉਂਕਿ ਈਬੁੱਕ ਸਾਡੇ ਫੋਨ 'ਚ ਹੁੰਦੀ ਹੈ ਅਤੇ ਫੋਨ ਵਿੱਚ ਡਾਟਾ ਇਹ ਸੇਵ ਰਹਿੰਦਾ ਅਤੇ ਇਹ ਆਪਾਂ ਜਦੋਂ ਕਿਸੇ ਦੂਜੇ ਨੂੰ ਵੀ ਸ਼ੇਅਰ ਕਰਦੇ ਹਾਂ ਤਾਂ ਉਸ ਦਾ ਵੀ ਫਾਇਦਾ ਕੀ ਉਹ ਵੱਧ ਲੋਕਾਂ ਨੂੰ ਪੜ੍ਹਨ ਨੂੰ ਮਿਲਦੀ ਹੈ ਜੇ ਆਪਾਂ ਹੱਥ ਜਿਲਦ ਦੀ ਗੱਲ ਕਰ ਦੇਈਏ ਹੱਥ ਜਿਲਦ ਇੱਕ ਸਮੇਂ ਇੱਕ ਬੰਦਾ ਹੀ ਪੜ੍ਹ ਸਕਦਾ ਪਰ ਈਬੁੱਕ ਆ ਇੱਕ ਸਮੇਂ ਅਨੇਕਾਂ ਹੀ ਲੋਕ ਆ ਜਿਹੜੇ ਉਹ ਪੜ੍ਹ ਸਕਦੇ ਹੈਗੇ ਇਹ ਸਭ ਤੋਂ ਵੱਡਾ ਇਹਦਾ ਫਾਇਦਾ ਇਸ ਦੇ ਨਾਲ ਹੀ ਇਹ ਇੱਕ ਸਸਤਾ ਸਾਧਨ ਹੈ ਇਹ ਹਰ ਇੱਕ ਦੀ ਪਹੁੰਚ ਵਿੱਚ ਆ ਸਕਦਾ